ਪੰਜਾਬ ਵਿੱਚ ਬਹੁਤ ਸਾਰੀਆਂ ਖੇਡਾਂ ਖੇਡੀਆਂ ਜਾਂਦੀਆਂ ਨੇ ਜਿਵੇਂ ਕਿ ਕਬੱਡੀ ਹੋ ਗਈ ਖੋ ਖੋ ਹੋ ਗਈ ਕੁਸ਼ਤੀ ਹੋ ਗਈ ਅਤੇ ਆਪਣੀ ਕ੍ਰਿਕਟ ਹੋ ਗਈ ਫੁੱਟਬਾਲ ਹੋ ਗਈ ਵਾਲੀਬੋਲ ਹੋ ਗਈ ਇਹ ਸਾਰੀਆਂ ਟ ਖੇਡਾਂ ਖੇਡੀਆਂ ਜਾਂਦੀਆਂ ਨੇ ਜਿਹੜੇ ਕਿ ਗੱਲ ਕੀਤੀ ਜਾਵੇ ਆਪਣੇ ਜਿਹੜੇ ਅੰਗਹੀਣ ਹੁੰਦੇ ਨੇ ਜਾਂ ਜਿਨ੍ਹਾਂ ਨੂੰ ਮਤਲਬ ਕਿ ਆਪਾਂ ਕਹਿ ਦਿੰਦੇ ਇਹ ਜਿਹੜੀਆਂ ਪੈਰਾਂ ਜਿੱਦਾਂ ਲੋਕ ਹੁੰਦੇ ਨੇ ਜਿਹੜੇ ਉਹਨਾਂ ਲਈ ਵੀ ਬਹੁਤ ਸਾਰੀਆਂ ਖੇਡਾਂ ਹੁੰਦੀਆਂ ਨੇ ਉਹ ਵੀ ਆਪਣੇ ਮਤਲਵ ਕੀ ਪੱਧਰ 'ਤੇ ਬਹੁਤ ਸਾਰੀਆਂ ਖੇਡਾਂ ਖੇਡਦੇ ਨੇ ਅੰਗਹੀਣ ਲਈ ਬਹੁਤ ਸਾਰੀਆਂ ਖੇਡਾਂ ਹੈਗੀਆਂ ਨੇ ਸਕੀਮਾਂ ਨੇ ਲੋਕਾਂ ਦੀਆਂ ਜਿਹੜੀਆਂ ਮਤਲਬ ਕਿ ਹੈਗੀਆਂ ਨੇ ਉਹਦੇ ਵਿੱਚ ਵੀ ਬਹੁਤ ਸਾਰੀਆਂ ਉਹ ਖੇਡਾਂ ਖੇਡਦੇ ਨੇ ਸਰਕਾਰ ਦੁਆਰਾ ਅਲੱਗ ਤੋਂ ਮਤਲਬ ਕਿ ਇੱਕ ਉਹਨਾਂ ਲਈ ਟੂਰਨਾਮੈਂਟ ਕਰਵਾਇਆ ਜਾਂਦਾ ਆਯੋਜਿਤ ਕੀਤਾ ਜਾਂਦਾ ਜਿਹਦੇ ਵਿੱਚ ਉਹ ਸਾਰੇ ਬੱਚੇ ਵੀ ਆਪਣਾ ਯੋਗਦਾਨ ਦਿੰਦੇ ਨੇ ਅਤੇ ਕੁਛ ਕੁ ਬੱਚੇ ਹੁੰਦੇ ਨੇ ਮਤਲਬ ਕਿ ਜਿਹੜੇ ਅ ਅੰਗਹੀਣ ਤਾਂ ਹੁੰਦੇ ਨੇ ਮਤਲਬ ਕਿ ਥੋੜ੍ਹੇ ਬਹੁਤੇ ਹੁੰਦੇ ਨੇ ਜਾਂ ਕੁਛ ਕੁ ਪਰਸੈਂਟ ਕਹਿ ਦਿੰਦੇ ਆਪਾਂ ਪੰਜ ਦਸ ਪ੍ਰਸੈਂਟ ਉਹ ਤਾਂ ਵੈਸੇ ਨੋਰਮਲੀ ਜਿਹੜੇ ਦੂਜੇ ਬੱਚੇ ਹੁੰਦੇ ਨੇ ਉਹਨਾਂ ਨਾਲ ਵੀ ਖੇਡ ਲੈਂਦੇ ਨੇ